ਹਾਂਜੀ ਮੈਂ ਜ਼ਿਆਦਾਤਰ ਗਰਮੀ ਦੇ ਮੌਸਮ ਵਿੱਚ ਰਾਤ ਦੇ ਸਮੇਂ ਬਾਹਰ ਨਿਕਲ ਫਿਰਨਾ ਘੁੰਮਣਾ ਫਿਰਨਾ ਪਸੰਦ ਕਰਦਾਂ ਅਤੇ ਜ਼ਿਆਦਾਤਰ ਅਸੀਂ ਬਾਹਰ ਜਿਹੜਾ ਹੈ ਆਊਟਿੰਗ ਜਾਂਦੇ ਹਾਂ ਘੁੰਮਣ ਫਿਰਨ ਦੇ ਲਈ ਲੰਬੀ ਯਾਤਰਾ 'ਤੇ ਉਹ ਜਾਂਦੇ ਜੀ ਅਸੀਂ ਛੁੱਟੀਆਂ ਦੇ ਵਿੱਚ ਹੀ ਜੂਨ ਦੀਆਂ ਛੁੱਟੀਆਂ 'ਚ ਜਾਂ ਦਸੰਬਰ ਦੀਆਂ ਛੁੱਟੀਆਂ ਦੇ ਵਿੱਚ ਦਸੰਬਰ ਦੀਆਂ ਛੁੱਟੀਆਂ ਦੇ ਵਿੱਚ ਪਹਾੜੀ ਏਰੀਏ 'ਚ ਬਹੁਤ ਜ਼ਿਆਦਾ ਠੰਡਕ ਹੁੰਦੀ ਹੈ ਅਤੇ ਉੱਧਰ ਜਾਣ ਤੋਂ ਅਸੀਂ ਗੁਰੇਜ਼ ਕਰਦੇ ਹਾਂ ਜੀ ਅਤੇ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਪਹਾੜੀ ਏਰੀਏ ਦੀ ਦਾ ਸਫ਼ਰ ਕਰਦੇ ਹਾਂ ਕਿਉਂਕਿ ਉੱਥੇ ਮੌਸਮ ਠੰਡਾ ਹੁੰਦਾ ਹੈ ਪੰਜਾਬ ਵਿੱਚ ਗਰਮੀ ਹੁੰਦੀ ਹੈ ਅਤੇ ਸਰਦੀ ਦੇ ਵਿੱਚ ਮੌਸਮ ਦੇ ਵਿੱਚ ਅਸੀਂ ਦਿੱਲੀ ਵਗੈਰਾ ਜਾਂ ਦਿੱਲੀ ਦੇ ਨਾਲ਼ ਲੱਗਦੇ ਏਰੀਏ ਵਿੱਚ ਹਰਿਆਣੇ ਵਗੈਰਾ ਦੇ ਵਿੱਚ ਛੁੱਟੀਆਂ ਦਾ ਆਨੰਦ ਲੈਂਦੇ ਹਾਂ ਪੰਜਾਬ ਦੇ ਵਿੱਚ ਸਰਦੀ ਦਾ ਜਿਹੜਾ ਮੌਸਮ ਹੈ ਉਹ ਦਸੰਬਰ 'ਚ ਹੁੰਦਾ ਦਸੰਬਰ ਦੇ ਵਿੱਚ ਹੀ ਛੁੱਟੀਆਂ ਹੁੰਦੀਆਂ ਨੇ ਅਤੇ ਪੰਜਾਬ 'ਚ ਵੀ ਪਟਿਆਲੇ 'ਚ ਵੀ ਸਰਦੀ ਕਾਫ਼ੀ ਹੁੰਦੀ ਹੈ ਪਰ ਦਿੱਲੀ ਤੋਂ ਅੱਗੇ ਜਿਹੜਾ ਹੈ ਉਹ ਘੱਟ ਹੁੰਦੀ ਹੈ ਇਸ ਕਰਕੇ ਜੈਪੁਰ ਜਾਂ ਉਹਦੇ ਨਾਲ਼ ਲੱਗਦੇ ਏਰੀਏ ਹਨੁੰਮਾਨਗੜ੍ਹ ਵਗੈਰਾ ਇਹਨਾਂ ਏਰੀਏ ਦੇ ਵਿੱਚ ਜਿਵੇਂ ਕਿ ਗੰਗਾ ਨਗਰ ਹੋ ਗਿਆ ਇਹਨਾਂ ਏਰੀਆ ਵਿੱਚ ਅਸੀਂ ਇਹ ਤੋਂ ਅੱਗੇ ਘੁੰਮਣ ਜਾਂਦੇ ਹਾਂ ਜੀ ਸਰ ਗਰਮੀ ਦੇ ਸਰਦੀ ਦੀਆਂ ਛੁ ਛੁੱਟੀਆਂ ਦੇ ਵਿੱਚ